ਹਾਂਜੀ ਜੇ ਆਪਾਂ ਦੇਖੀਏ ਨਾ ਜਿਹੜਾ ਭੰਗੜਾ ਗਾ ਪ੍ਰਦਰਸ਼ਨ ਦੇ ਲਈ ਜਿਹੜੇ ਉਹਨੂੰ ਪੈ ਪਹਿਰਾਵੇ ਦੇ ਲਈ ਜਿਹੜੇ ਉਹ ਕੱਪੜੇ ਪਹਿਣਦੇ ਆ ਨਾ ਉਹ ਬਹੁਤ ਹੀ ਖ਼ਾਸ ਤਰੀਕੇ ਦੇ ਨਾਲ ਚੁਣਦੇ ਆ ਭਾਈ ਉਹ ਤਾਂ ਉਹਦੇ ਵਿੱਚ ਕੀ ਹੈ ਜੋ ਪਹਿਰਾਵਾ ਇੰਨਾ ਵਧੀਆ ਪਾਉਂਦੇ ਆ ਨਾ ਉਸ ਨੂੰ ਤੁਸੀਂ ਜਿਹੜਾ ਨਾਚ ਨੱਚਦੇ ਆ ਉਹ ਪਹਿਰਾਵੇ ਦੇ ਨਾਲ ਹੀ ਬਹੁਤ ਸੋਹਣਾ ਲੱਗਦਾ ਉਹਨਾਂ ਦਾ ਠੀਕ ਹੈ ਇੱਕ ਵੱਖਰੀ ਪਹਿਚਾਣ ਕਹਿੰਦੇ ਬਣ ਜਾਂਦੀ ਉਹਨਾਂ ਦੀ ਅਤੇ ਜਿਹੜੇ ਭੰਗੜੇ ਪਾਉਣ ਵੇਲੇ ਜਿਹੜੇ ਕੀ ਆ ਮਰਦ ਆ ਅੱਡ ਤਰ੍ਹਾਂ ਦੇ ਕੱਪੜੇ ਪਹਿਣਦੇ ਆ ਔਰਤਾਂ ਅੱਡ ਤਰ੍ਹਾਂ ਦੇ ਕੱਪੜੇ ਪਹਿਣਦੀਆਂ ਤਾਂ ਜੋ ਉਹਨਾਂ ਦੀ ਦਿੱਖ ਬਹੁਤ ਪ੍ਰਭਾਵਸ਼ਾਲੀ ਬਣੇ ਅਤੇ ਜਿਹੜੇ ਕੀ ਆ ਨਾਮ ਆਪਾਂ ਲੋਕ ਭੰਗੜਾ ਦੇਖਦੇ ਹਾਂ ਆਪਾਂ ਨੂੰ ਸੋਹਣੇ ਲੱਗਣ ਠੀਕ ਹੈ ਭੰਗੜਾ ਤਾਂ ਉਹ ਵੀ ਪਾਈ ਜਾਂਦੇ ਆ ਪਰ ਜਦੋਂ ਸੋਹਣੀ ਪੁਸ਼ਾਕ ਪਾਈ ਹੋਵੇ ਉਹ ਕੋਈ ਹੋਰ ਵੱਖਰੀ ਹੀ ਇਹਨਾਂ ਦੇ ਨਜ਼ਾਰਾ ਆਉਂਦਾ ਆਪਾਂ ਨੂੰ ਦੇਖਣ ਦੇ ਵੇਲੇ ਜੇ ਆਪਾਂ ਬੰਦਿਆਂ ਦੀ ਗੱਲ ਕਰੀਏ ਹੈ ਨਾ ਬੰਦੇ ਆ ਜਿਹੜੇ ਕੁੜਤੇ ਪਜਾ ਚਾਦਰਾ ਬੰਨਦੇ ਨੇ ਅਤੇ ਕੁੜਤਾ ਚਾਦਰਾ ਪੂਰਾ ਚਮਕਦਾਰ ਰੰਗਾਂ ਵਾਲਾ ਹੁੰਦਾ ਉਹਨਾਂ ਦਾ ਕਢਾਈ ਕੱਢੀ ਹੁੰਦੀ ਹੈ ਕਿੰਨੇ ਸੋਹਣੇ ਬੂਟੇ ਪਾਏ ਹੁੰਦੇ ਆ ਇਹਨਾਂ ਦੇ ਹੈ ਨਾ ਅਤੇ ਜੁੱਤੀਆਂ ਬੜੀਆਂ ਤਿੱਲੇਦਾਰ ਹੁੰਦੀਆਂ ਕਿੰਨੀਆਂ ਸੋਹਣੀਆਂ ਫੱਬਦੀਆਂ ਗੀਆਂ ਅਤੇ ਪਗੜੀ ਹੈਗੀ ਪਗੜੀ ਨੂੰ ਉਹ ਕਿਵੇਂ ਤੁਰਲਾ ਲਗਾਉਂਦੇ ਨੇ ਨਾ ਕਿੰਨਾ ਘੈਂਟ ਲੱਗਦਾ ਕਿੰਨੀ ਵਧੀਆ ਲੁੱਕ ਹੁੰਦੀ ਜਦੋਂ ਨਵੇਂ ਨਵੇਂ ਐਕਸ਼ਨ ਕਰਦੇ ਆ ਮੋਰਚਾਲ ਭੰਗੜਾ ਪਾਉਂਦੇ ਆ ਹੈ ਨਾ ਝੂਮਰ ਪਾਉਂਦੇ ਆ ਤਾਂ ਉਹ ਉਹਦੀ ਵਿਲੱਖਣਤਾ ਹੀ ਕੁਛ ਹੋਰ ਹੈਗੀ ਹੈ ਨਾ ਜਿਹੜਾ ਭੰਗੜਾ ਪਾਉਂਦੇ ਆ ਅਤੇ ਪਸ਼ਾਕਾ ਇੱਕ ਖ਼ਾਸ ਮਹੱਤਤਾ ਰੱਖਦੀਆਂ ਹੈ ਇਸ ਤਰ੍ਹਾਂ ਜਿਵੇਂ ਆਪਾਂ ਔਰਤਾਂ ਦੀ ਗੱਲ ਕਰੀਏ ਔਰਤਾਂ ਵੀ ਬਹੁਤ ਹੀ ਧਮਕ ਤਮੜਲੇਦਾਰ ਪੂਰੇ ਘੈਂਟ ਜਿਹੜੇ ਸੂਟ ਜਿਹੜੇ ਪਾਉਂਦੀਆਂ ਨੇ ਗੋਟੇ ਜੜੇ ਦੇ ਕਢਾਈ ਨਾਲ ਕੱਢੇ ਹੋਏ ਅਤੇ ਕੰਨਾਂ ਦੇ ਵਿੱਚ ਝੁਮਕੇ ਅਤੇ ਲੋਟਣ ਪਿੱਪਲ ਪੱਤੀਆਂ ਹਨਾ ਕਿੰਨਾ ਕੁਛ ਪਾਉਂਦੀਆਂ ਨੇ ਸਿਰਾਂ ਦੇ ਉੱਪਰ ਹੈ ਪੂਰੇ ਸੂਬਰ ਲੈਂਦੀਆਂ ਨੇ ਦੋਹਰਾ ਦੁਪੱਟਾ ਲੈਂਦੀਆਂ ਨੇ ਹੈ ਨਾ ਉਹਨੂੰ ਸੂਬਰ ਬੋਲਦੇ ਆ ਗੇ ਆਪਾਂ ਅਤੇ ਆਹ ਆਪਣਾ ਕੀ ਕਹਿੰਦੇ ਜੁੱਤੀਆਂ ਪੂਰੀਆਂ ਚਮਕਦੀਆਂ ਹੁੰਦੀਆਂ ਉਹਨਾਂ ਦੀਆਂ ਪੂਰੀਆਂ ਘੈਂਟ ਹੁੰਦੀਆਂ ਹੈਗੀਆਂ ਅਤੇ ਹੱਥਾਂ ਦੇ ਵਿੱਚ ਚੂੜੀਆਂ ਪਾਈਆਂ ਹੁੰਦੀਆਂ ਨੇ ਹੈ ਨਾ ਠੀਕ ਹੈ ਅਤੇ ਜਿਹੜੇ ਸਾਰੀਆਂ ਚੀਜ਼ਾਂ ਕੀ ਹੈ ਨਾ ਇੱਕ ਉਹ ਨਾਲਾ ਬੁਲ ਲਮਕਦਾ ਹੁੰਦਾ ਫੁੱਲਾਂ ਵਾਲਾ ਉਹ ਸਾਈਡ 'ਤੇ ਨਾ ਨਾਲੇ ਦੀ ਦਿੱਕਤ ਦਿੱਖ ਦਿਖਾਉਣ ਦੇ ਵਾਸਤੇ ਫੁੱਲਾਂ ਦਾ ਇੱਕ ਗੁਲਦਸਤਾ ਜਿਹਾ ਹੁੰਦਾ ਛੋਟੇ ਛੋਟੇ ਫੁੱਲ ਹੁੰਦੇ ਆ ਰੰਗ ਬਿਰੰਗੇ ਉੱਪਰ ਸੱਗੀ ਦੇ ਉਹ ਕੀ ਹੈ ਬਹੁਤ ਵਧੀਆ ਲੱਗਦੇ ਨੇ ਤਾਂ ਇਸ ਲਈ ਆਪਾਂ ਨੂੰ ਇਹ ਮੰਨਣਾ ਹੀ ਪਵੇਗਾ ਜਿਹੜਾ ਪਹਿਰਾਵਾ ਹੈਗਾ ਨਾ ਡਾਂਸ ਕਰਨ ਵਾਲਿਆਂ ਨੂੰ ਇੱਕ ਵਿਲੱਖਣ ਤੌਰ 'ਤੇ ਆਕਰਸ਼ਕ ਬਣਾਉਂਦਾ ਹੈਗਾ ਸਾਨੂੰ ਦੇਖਣ ਨੂੰ ਬਹੁਤ ਜ਼ਿਆਦਾ ਜੀਅ ਕਰਦਾ ਉਹਨਾਂ ਨੂੰ ਜਦੋਂ ਨਵੇਂ ਨਵੇਂ ਐਕਸ਼ਨ ਕਰਦੇ ਆ ਉਹਨਾਂ ਪਹਿਰਾਵੇ ਦੇ ਵਿੱਚ ਹਾਂਜੀ ਬਹੁਤ ਬਹੁਤ ਧੰਨਵਾਦ ਬਾਈ ਜੀ